ਮੈਂ ਮੂਰਤੀ ਬਹੁਤ ਵੱਡੀ ਇੱਕ ਵਾਰ ਬਣਾਈ ਸੀਗੀ ਦਿਵਾਲੀ ਦੇ ਟਾਈਮ ਲਕਸ਼ਮੀ ਮਾਤਾ ਦੀ ਮੂਰਤੀ ਬਣਾਈ ਸੀ ਉਹ ਬਹੁਤ ਹੀ ਸੋਹਣੀ ਬਣੀ ਸੀ ਕਿਉਂਕਿ ਉਹਦੀ ਪ੍ਰੇਰਨਾ ਮੇਰੀ ਮਾਸੀ ਜੀ ਦੀ ਬੇਟੀ ਸੀ ਕਿਉਂਕਿ ਉਹਨੇ ਆਰਟ ਐਂਡ ਪੇਟਿੰਗ ਰੱਖਿਆ ਹੋਇਆ ਸੀ ਉਹਨੂੰ ਇਹ ਚੀਜ਼ਾਂ ਦਾ ਬਹੁਤ ਸ਼ੌਕ ਸੀ ਉਹਨੂੰ ਦੇਖ ਦੇਖ ਕੇ ਮੇਰੇ ਅੰਦਰ ਵੀ ਇਹ ਸ਼ੌਕ ਜਾਗ ਗਿਆ ਅਤੇ ਜਦੋਂ ਉਹ ਬਣਾਉਂਦੀ ਸੀ ਮੈਂ ਉਹਨੂੰ ਦੇਖਦੀ ਰਹਿੰਦੀ ਸੀ ਤਾਂ ਉਹ ਬਹੁਤ ਸੋਹਣੀਆਂ ਲੱਗਦੀਆਂ ਸੀ ਤਾਂ ਮੇਰਾ ਦਿਲ ਕੀਤਾ ਕਿ ਮੈਂ ਵੀ ਦਿਵਾਲੀ 'ਤੇ ਲਕਸ਼ਮੀ ਮਾਤਾ ਦੀ ਇੱਕ ਮੂਰਤੀ ਬਣਾਵਾਂ ਅਤੇ ਮੈਂ ਉਹ ਮੂਰਤੀ ਬਣਾਉਂਦੀ ਹੁੰਦੀ ਸੀ ਤਾਂ ਉਹ ਬਹੁਤ ਸੋਹਣੀ ਬਣ ਗਈ ਬਹੁਤ ਵੱਡੀ ਬਣਾਈ ਸੀ ਅਤੇ ਬਾਅਦ 'ਚ ਮੈਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਇਸ ਕਰਕੇ ਕਰਨਾ ਪਿਆ ਕਿਉਂਕਿ ਮੇਰੀ ਮਾਸੀ ਜੀ ਦੀ ਬੇਟੀ ਸ਼ਹਿਰ ਦੇ ਵਿੱਚ ਰਹਿਣ ਹੋਣ ਕਰਕੇ ਉਹਨੂੰ ਮਟੀਰੀਅਲ ਬਹੁਤ ਵਧੀਆ ਪ੍ਰੋਵਾਈਡ ਹੁੰਦਾ ਸੀ ਅਤੇ ਇੱਕ ਛੇਤੀ ਪ੍ਰੋਵਾਈਡ ਹੋ ਜਾਂਦਾ ਸੀ ਮੈਂ ਇਹੋ ਜਿਹੀ ਜਗ੍ਹਾ 'ਤੇ ਰਹਿੰਦੀ ਹਾਂ ਜਿੱਥੇ ਮੈਨੂੰ ਮਟੀਰੀਅਲ ਉੱਦਾਂ ਦਾ ਨਹੀਂ ਮਿਲਿਆ ਮਿਲ ਕੁਛ ਕੁ ਮਿਲ ਗਿਆ ਸੀ ਉਹ ਵੀ ਐਨਾ ਕੁਛ ਐਨਾ ਵਧੀਆ ਨਹੀਂ ਸੀ ਡੱਲ ਜਿਹੇ ਕਲਰ ਸੀ ਪੁਰਾਣਾ ਜਿਹਾ ਸੀਗਾ ਥੋੜ੍ਹਾ ਤਾਂ ਉਹਦੇ ਨਾਲ ਐਨੀ ਮੂਰਤੀ ਉੱਭਰ ਕੇ ਨਹੀਂ ਆਈ ਜਿੰਨੀ ਉਹਦੀ ਉੱਭਰਦੀ ਸੀ ਤਾਂ ਮੈਨੂੰ ਇਹ ਚੁਣੌਤੀ ਥੋੜ੍ਹੀ ਜਿਹੀ ਲੱਗੀ ਬਾਕੀ ਮੈਂ ਮੂਰਤੀ ਬਹੁਤ ਸੋਹਣੀ ਬਣਾਈ ਸੀ ਅਤੇ ਮੇਰੀ ਮਾਸੀ ਜੀ ਦੀ ਬੇਟੀ ਨੇ ਵੀ ਤਾਰੀਫ ਕੀਤੀ ਕਿ ਬਿਲਕੁਲ ਤੂੰ ਮੇਰੇ ਮੂਰਤੀ ਵਰਗੀ ਮੂਰਤੀ ਬਣਾ ਲਈ ਆ ਮੈਂ ਉਸ ਟਾਈਮ ਇਹ ਮੂਰਤੀ ਬਣਾਈ ਸੀ